ਪਿੰਡਾਂ ਵਿੱਚ ਖੇਡਣ ਖੇਡਾਂ ਖੇਡਣ ਨਾਲ ਬਹੁਤ ਜ਼ਿਆਦਾ ਵਿਕਸ ਹੁਨਰ ਵਿਕਸਤ ਹੁੰਦਾ ਹੈ ਜਿਨ੍ਹਾਂ ਵਿੱਚ ਜਿਵੇਂ ਕਿ ਕਬੱਡੀ ਨਾਲ ਅਤੇ ਕੁਸ਼ਤੀ ਨਾਲ ਕਬੱਡੀ ਜਿਵੇਂ ਕਿ ਕਬੱਡੀ ਤਾਂ ਕਬੱਡੀ ਵਿੱਚ ਬਹੁਤ ਜ਼ਿਆਦਾ ਜ਼ੋਰ ਅਤੇ ਤਾਕਤ ਦੀ ਲੋੜ ਪੈਂਦੀ ਹੈ ਜਿਵੇਂ ਕਿ ਇਸ ਦੇ ਵਿੱਚ ਫੁਰਤੀ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਅਤੇ ਇਸ ਦੇ ਨਾਲ ਬੰਦਾ ਫਿੱਟ ਵੀ ਰਹਿੰਦਾ ਹੈ ਅਤੇ ਕੁਸ਼ਤੀ ਦੀ ਗੱਲ ਕਰੀਏ ਕੁਸ਼ਤੀ ਵਿੱਚ ਵੀ ਦੰਗਲ ਵਗੈਰਾ ਸਾਰਾ ਕੁਛ ਹੁੰਦਾ ਹੈ ਅਤੇ ਇਸ ਨਾਲ ਸਾਡਾ ਮਤਲਬ ਕਿ ਸਾਰਾ ਚਰਿੱਤਰ ਦਾ ਪਤਾ ਲੱਗਦਾ ਹੈ ਅਤੇ ਇਸ ਨਾਲ ਬਹੁਤ ਜ਼ਿਆਦਾ ਹੁਨਰ ਵਿਕਸਤ ਹੁੰਦਾ ਹੈ ਸਾਡਾ